ਅਤੇ ਅਸੀਂ ਸਾਡੇ ਪਰਿਵਾਰ ਨੇ ਇਹੀ ਡਾਟਾ ਬ ਲਿਆ ਹੋਇਆ ਹੈ ਵੈਸੇ ਤਾਂ ਇਹ ਇੱਕ ਹੈਬਿਟ ਬਣ ਗਈ ਹੈ ਹੁਣ ਇਹਨੂੰ ਨੱਤ ਪਾਉਣੀ ਇਹਨੂੰ ਮੁੜਿਆ ਔਖਾ ਹੈ ਮਜ਼ਬੂਰੀ ਕਾਰਨ ਸਾਨੂੰ ਇਹ ਡਾਟਾ ਬ ਲੈਣ ਲੈਣਾ ਹੀ ਪੈਂਦਾ ਹੈ ਇਹਤੋਂ ਵਗੈਰਾ ਅੱਜ ਕੱਲ੍ਹ ਅੱਗੇ ਸਾਡਾ ਵੱਧਣਾ ਮੁਸ਼ਕਿਲ ਹੈ